ਕੀ ਆਵਾਜਾਈ ਦੀ ਸਹੂਲਤਾਂ ਦੀ ਘਾਟ ਸਿਹਤ ਸੰਭਾਲ ਤੱਕ ਪਹੁੰਚ ਨੂੰ ਪ੍ਰਾਪਤ ਕਰਦੀਆਂ ਹੈ ਹਾਂਜੀ ਬਹੁਤ ਕਰਦੀਆਂ ਕਿਉਂਕਿ ਜੇ ਸ਼ਹਿਰ ਦੇ ਅੰਦਰ ਹੋਸਪੀਟਲ ਹੋਵੇ ਤਾਂ ਸਾਨੂੰ ਹੋਸ ਪਹੁੰਚਣਾ ਬਹੁਤ ਬਹੁਤ ਨੁਕਸਾਨ ਹੁੰਦਾ ਹੈ ਕਿਉਂਕਿ ਉਸਦੀ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਸਰਕਾਰ ਲਈ ਹੋਸਪਿਟਲ ਸ਼ਹਿਰ ਤੋਂ ਬਾਹਰ ਬਣਾਏ ਹੁੰਦੇ ਹਨ ਕਿ ਬੰਦੇ ਨੂੰ ਕੋਈ ਦਿੱਕਤ ਨਾ ਆਵੇ ਜਾਣ ਲਈ ਜਿੱਦਾਂ ਕਿ ਬਾਈ ਚਾਂਸ ਬੰਦਾ ਜ਼ਿਆਦਾ ਸੀਰੀਅਸ ਹੁੰਦਾ ਹੈ ਤਾਂ ਉਹ ਟ੍ਰੈਫਿਕ ਵਿੱਚ ਹੀ ਫਸ ਜਾਂਦਾ ਹੈ ਇਸ ਲਈ ਸਰਕਾਰ ਨੇ ਹੋਸਪਿਟਲ ਡਿਸਪੈਂਸਰੀਆਂ ਆਦੀ ਇਹ ਸਾਰੀ ਸ਼ਹਿਰ ਤੋਂ ਬਾਹਰ ਬਣਾਈਆਂ ਹੁੰਦੀਆਂ ਹਨ ਜਾਂ ਪਿੰਡਾਂ ਦੇ ਰੋਡਾਂ ਉੱਤੇ ਬਣਾਈਆਂ ਹੁੰਦੀਆਂ ਹਨ ਅਤੇ ਉੱਥੇ ਦੇ ਰੋਡ ਸਿੱਧੇ ਸਾਫ ਸੁਥਰੇ ਹੁੰਦੇ ਹਨ ਨਾ ਸਾਨੂੰ ਉੱਥੇ ਇੰਨਾ ਟਰੈਫਿਕ ਕਰਨਾ ਚਾਹੀਦਾ ਹੈ ਅਤੇ ਸਾਨੂੰ ਜਿੱਦਾਂ ਕਿ ਐਬੂਲੈਂਸ ਲੰਘਦੀ ਹੋਵੇ ਤਾਂ ਉਹਨੂੰ ਸੈਡ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਟਰੈਫਿਕ ਜ਼ਿਆਦਾ ਹੋ ਗਈ ਹੈ ਆਵਾਜਾਈ ਦੇ ਸਾਧਨ ਤਾਂ ਸਾਨੂੰ ਰੋਡ 'ਤੇ ਹੌਲੀ ਚੱਲਣਾ ਚਾਹੀਦਾ ਹੈ ਅਤੇ ਐਬੂਲੈਂਸ ਨੂੰ ਸੈਡ ਦੇਣੀ ਚਾਹੀਦੀ ਹੈ ਅਤੇ ਹੁਣ ਹੋਸਪਿਟਲ ਬਾਹਰਲੇ ਪਾਸੇ ਹੋਣ ਕਾਰਨ ਤਾਂ ਸਾਡਾ ਬਹੁਤ ਘੱਟ ਸਮਾਂ ਲੱਗਦਾ ਹੈ ਅਤੇ ਸਾਨੂੰ ਹੁਣ ਹੋਸਪਿਟਲ ਜਾਣ ਲਈ ਬਹੁਤਾ ਸਮਾਂ ਨਹੀਂ ਲਾਉਣਾ ਪੈਂਦਾ ਹੈ ਕਿਉਂਕਿ ਰੋਡ ਦੇ ਉੱਪਰ ਹੋਣ ਕਾਰਨ ਹੋਸਪਿਟਲ ਨੂੰ ਬਹੁਤ ਘੱਟ ਟਾਈਮ ਲੱਗਦਾ ਹੈ